ਹਾਂਜੀ ਬਾਈ ਜੀ ਮੈਂ ਸੋਚ ਰਿਹਾ ਸੀਗਾ ਵੀ ਮੈਂ ਅਗਲੇ ਮਹੀਨੇ ਦੀ ਪੰਦਰ੍ਹਾਂ ਤੋਂ ਵੀਹ ਤਰੀਕ ਦੇ ਵਿੱਚ ਆਪਣੇ ਪਰਿਵਾਰ ਨੂੰ ਮਿਲਣ ਲਈ ਜਾਣ ਲਈ ਕਿਉਂਕਿ ਕਾਫ਼ੀ ਸਮਾਂ ਹੋ ਗਿਆ ਮੈਨੂੰ ਇੱਥੇ ਤੁਹਾਨੂੰ ਪਤਾ ਹੀ ਹੈ ਜੋਬ ਦੀ ਜਿਹੜੀ ਹੁੰਦੀ ਹੈ ਮਜ਼ਬੂਰੀਆਂ ਇਹਨਾਂ ਦੀ ਵਜ੍ਹਾ ਨਾਲ ਬੰਦਾ ਬਿਜੀ ਸ਼ਡਿਊਲ 'ਚ ਰਹਿੰਦਾ ਹੈ ਇਸ ਕਰਕੇ ਹੁਣ ਮੈਂ ਪੰਦਰ੍ਹਾਂ ਜਾਂ ਵੀਹ ਤਰੀਕ ਦੇ ਵਿੱਚ ਗਵਾਲੀਅਰ ਤੋਂ ਬਠਿੰਡਾ ਤੱਕ ਦੀ ਸੀ ਸੀਟ ਹੈ ਜਿਹੜੀ ਉਹ ਬੁੱਕ ਕਰਨੀ ਚਾਹੁੰਦਾ ਸੈਕਿੰਡ ਏ ਸੀ ਦੀ ਤਾਂ ਇਹਦੇ ਬਾਰੇ ਤੁਸੀਂ ਮੈਨੂੰ ਸਹੀ ਰਾਏ ਦੱਸੋ ਵੀ ਕਿਹੜੀ ਤਰੀਕ ਨੂੰ ਆਪਾਂ ਨੂੰ ਟਿਕਟ ਮਿਲ ਸਕਦੀ ਹੈ ਇੱਕ ਇਹਦੇ ਵਿੱਚ ਹੋਰ ਕੰਮ ਕਰਨਾ ਵੀ ਆਪਾਂ ਨੂੰ ਇਸ ਹਿਸਾਬ ਨਾਲ ਟਿਕਟਾਂ ਸ ਬੁੱਕ ਕੀਤੀਆਂ ਜਾਣ ਵੀ ਮੈਨੂੰ ਦੋ ਜਾਂ ਤਿੰਨ ਘੰਟਿਆਂ ਦਾ ਸਮਾਂ ਜਿਹੜਾ ਹੈ ਗਾ ਉਹ ਦਿੱਲੀ ਦੇ ਵਿੱਚ ਮਿਲ ਸਕੇ ਕਿਉਂਕਿ ਦਿੱਲੀ ਦੇ ਵਿੱਚ ਕੁਛ ਕੁ ਪਰਿਵਾਰ ਵਾਸਤੇ ਖਰੀਦ ਦਾਰੀਆਂ ਕਰਨੀਆਂ ਹਨ ਅਤੇ ਦੋ ਜਾਂ ਤਿੰਨ ਘੰਟਿਆਂ ਦਾ ਸਮਾਂ ਜੇ ਆਪਾਂ ਨੂੰ ਉੱਥੇ ਮਿਲ ਜਾਂਦਾ ਹੈ ਤਾਂ ਉਸ ਤੋਂ ਬਾਅਦ ਅਗਲੀ ਗੱਡੀ ਦੀ ਬੁਕਿੰਗ ਉਸ ਹਿਸਾਬ ਨਾਲ ਕਰਨੀ ਹੈ ਆਪਾਂ ਵੀ ਆਪਾਂ ਨੂੰ ਨਾ ਤਾਂ ਜ਼ਿਆਦਾ ਟਾਈਮ ਉੱਥੇ ਲੱਗੇ ਅਤੇ ਨਾਲ ਆਪਾਂ ਟੈਮ ਨਾਲ ਆਪਣੇ ਘਰ ਨੂੰ ਪਹੁੰਚਦੇ ਹੋ ਜਾਈਏ ਮੈਂ ਤੁਹਾਨੂੰ ਆਪਣਾ ਆਈ ਡੀ ਅਤੇ ਪਾਸਵਰਡ ਭੇਜ ਦਿੰਦਾ ਹਾਂ ਉਹਦੇ ਵਿੱਚੋਂ ਤੁਸੀਂ ਮੈਨੂੰ ਟਿਕਟ ਬੁੱਕ ਕਰਕੇ ਦੱਸ ਦਿਉ ਵੀ ਕਿਹੜੀ ਤਰੀਕ ਦੀ ਟਿਕਟ ਆਪਣੀ ਬੁੱਕ ਹੋ ਰਹੀ ਹੈ ਅਤੇ ਇੰਨੀ ਕੁ ਮਿਹਰਬਾਨੀ ਜ਼ਰੂਰ ਕਰਿਓ ਵੀ ਦਿੱਲੀ ਦਾ ਜਿਹੜਾ ਦੋ ਤੋਂ ਤਿੰਨ ਘੰਟਿਆਂ ਦਾ ਸਮਾਂ ਮੈਂ ਤੁਹਾਨੂੰ ਕਿਹਾ ਉਹ ਮੈਨੂੰ ਮਿਲ ਜੇ ਤਾਂ ਕਿ ਮੈਂ ਹੁਣ ਕਾਫ਼ੀ ਸਮੇਂ ਬਾਅਦ ਘਰ ਵਾਪਸ ਆ ਰਿਹਾਂ ਪਰਿਵਾਰ ਨੂੰ ਮਿਲਣ ਤਾਂ ਪਰਿਵਾਰ ਵਾਸਤੇ ਚੀਜ਼ਾਂ ਸਮਾਨ ਖਰੀਦ ਸਕੀਏ